ਰੂਪਨਗਰ ਦੀਆਂ ਕਈ ਰਹੱਸਮਈ ਜਾਂ ਦਿਲਚਸਪ ਕਹਾਣੀਆਂ ਹਨ ਪਰ ਮੈਨੂੰ ਸੱਭ ਤੋਂ ਜ਼ਿਆਦਾ ਰਹੱਸਮਈ ਕਹਾਣੀ ਟਿੱਬੀ ਸਾਹਿਬ ਗੁਰਦੁਆਰਾ ਦੀ ਲੱਗਦੀ ਹੈ ਇਹ ਗੁਰਦੁਆਰਾ ਨਹਿਰ ਦੇ ਕੰਢੇ ਉੱਤੇ ਬਣਿਆ ਹੋਇਆ ਹੈ ਇੱਥੇ ਇਹ ਮੰਨਿਆ ਜਾਂਦਾ ਹੈ ਕਿ ਸੰਤਾਂ ਨੇ ਆਪਣੀ ਗੱਡੀ ਨੂੰ ਨਹਿਰ ਦੇ ਵਹਿੰਦੇ ਹੋਏ ਪਾਣੀ ਵਿੱਚੋਂ ਕੱਢ ਕੱਢ ਲਿਆ ਸੀ ਉਹ ਪਾਣੀ ਦੇ ਵਿੱਚ ਹੀ ਤੈਰ ਕੇ ਪਾਰ ਕਰਗੇ ਪਾ ਨਹਿਰ ਨੂੰ ਪਾਰ ਕਰ ਗਏ ਸਨ ਅਤੇ ਇਸ ਦਾ ਸਾਡੇ ਜ਼ਿਲ੍ਹੇ ਦੇ ਇਤਿਹਾਸ ਅਤੇ ਸੱਭਿਆਚਾਰ ਪਰ ਵੀ ਬਹੁਤ ਵੱਡਾ ਹਿੱਸਾ ਹੈ ਕਿਉਂਕਿ ਉੱਥੇ ਹੁਣ ਸੰਤਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣ ਗਿਆ ਹੈ ਜਿੱਥੇ ਬਹ ਕਈ ਲੋਕ ਆਉਂਦੇ ਜਾਂਦੇ ਹਨ ਅਤੇ ਉਸ ਨੂੰ ਇੱਕ ਧਾਰਮਿਕ ਸਥਾਨ ਮਨ ਮੰਨਿਆ ਜਾਂਦਾ ਹੈ